ਹਾਂਜੀ ਜਿਹੜੀ ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਹੈ ਨਾ ਇੱਕ ਅਮੀਰ ਵਿਰਾਸਤ ਹੈਗੀ ਜੋ ਸਦੀਆਂ ਤੋਂ ਹੀ ਇੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਦਾ ਇੱਕ ਅਨਿੱਖੜਵਾਂ ਅੰਗ ਰਹੀ ਹੈ ਆਓ ਆਪਾਂ ਹੁਣ ਇਹਦੇ ਬਾਰੇ ਗੱਲ ਕਰਦੇ ਹਾਂ ਵੀ ਪੰਜਾਬੀ ਕਲਾ ਅਤੇ ਸ਼ਿਲਪਕਾਰੀ ਨੇ ਫਿਲਮਾਂ ਫੈਸ਼ਨ ਸ਼ੋਆਂ ਅਤੇ ਇਤਿਹਾਸ ਦੇ ਵਿੱਚ ਇਹਨਾਂ ਨੂੰ

ਅਤੇ ਸੰਗੀਤ ਨੂੰ ਵਿਆਪਕ ਤੌਰ 'ਤੇ ਦਰਸਾਇਆ ਗਿਆ ਹੈ ਇਹ ਫਿਲਮਾਂ ਨੇ ਪੰਜਾਬੀ ਸੱਭਿਆਚਾਰ ਦੇ ਇਹਨਾਂ ਮਹੱਤਵਪੂਰਨ ਹਿੱਸਿਆਂ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ ਹੈਗਾ ਆਪਣੇ ਵਿਸ਼ੇਸ਼ ਪਹਿਰਾਵੇ ਦੀ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਸੂਟ ਸਲਵਾਰ ਕਮੀਜ ਜੁੱਤੇ ਅਤੇ ਹੋਰ ਪਰੰਪਰਾਗਤ ਪਹਿਰਾਵੇ ਨੂੰ ਦਰਸਾਇਆ ਗਿਆ ਹੈ ਅਤੇ ਜਿਸ ਨਾਲ ਜਿਹੜਾ ਸਾਡਾ ਪੰਜਾਬੀ ਫੈਸ਼ਨ ਨੂੰ ਪ੍ਰਸਿੱਧੀ ਮਿਲੀ ਹੈਗੀ ਪੰਜਾਬੀ ਪਿੰਡਾਂ ਦੇ ਜੀਵਨ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਜਿਹੜਾ ਪਿੰਡਾਂ ਵਾਲਾ ਜਿਹੜਾ ਜੀਵਨ ਹੈਗਾ ਪੰਜਾਬੀ ਦੀ ਦੀ ਕਲਾ ਉੱਥੋਂ ਦੀ ਸ਼ਿਲਪਕਾਰੀ ਦੇ ਤੱਤ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਨਾ ਪੰਜਾਬੀ ਫਿਲਮਾਂ ਵਿੱਚ ਵੀ ਜੇ ਆਪਾਂ ਫੈਸ਼ਨ ਸ਼ੋਆਂ ਦੀ ਗੱਲ ਕਰੀਏ ਕਿੰਨੇ ਫੈਸ਼ਨ ਸ਼ੋਅ ਹੁੰਦੇ ਨੇ ਉਹਨਾਂ ਵਿੱਚ ਜਿਹੜੇ ਲੜਕੀਆਂ ਨੇ ਪੰਜਾਬੀ ਸੂਟ ਅਤੇ ਸਲਵਾਰ ਕਮੀਜ ਨੂੰ ਅਕਸਰ ਆਪਾਂ ਵੇਖਦੇ ਹੈਗੇ ਵੀ ਉਹ ਆਪਦਾ ਫੈਸ਼ਨ ਸ਼ੋਅ ਦੇ ਵਿੱਚ ਯੂਜ਼ ਕਰਦੀਆਂ ਨੇ ਡਿਜ਼ਾਇਨਰਾਂ ਦੁਆਰਾ ਵੀ ਇਹਨਾਂ ਨੂੰ ਪੁਰਾਣੇ ਤਰੀਕਿਆਂ ਨਾਲ ਆਹ ਘੱਗਰੇ ਲਹਿੰਗੇ ਫੁਲਕਾਰੀਆਂ ਜਿਵੇਂ ਅੱਜ ਕੱਲ੍ਹ ਚੱਲਦੇ ਨੇ ਉਸ ਤੋਂ ਇਲਾਵਾ ਜੁੱਤੀਆਂ ਅਤੇ ਗਹਿਣੇ ਪੰਜਾਬੀ ਜੁੱਤੀ ਅਤੇ ਗਹਿਣੇ ਵੀ ਫੈਸ਼ਨ ਸ਼ੋਆਂ ਦੇ ਵਿੱਚ ਦਿਖਾਏ ਜਾਂਦੇ ਹਨ ਇਹ ਜਿਹੜੇ ਗਹਿਣੇ ਹੈ ਨਾ ਆਮ ਤੌਰ 'ਤੇ ਚਾਂਦੀ ਅਤੇ ਸੋਨੇ ਦੀ ਵੀ ਬਣੇ ਹੁੰਦੀ ਹਨ ਅਤੇ ਉਹਨਾਂ ਉੱਤੇ ਬਹੁਤ ਸਾਰੀ ਮੀਨਾਕਾਰੀ ਕੀਤੀ ਹੁੰਦੀ ਹੈ ਨਾ ਵੀ ਕਿੰਨੀਆਂ ਘੈਂਟ ਲੱਗਦੀਆਂ ਜੁੱਤੀਆਂ ਉਹ ਜੇ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਤਿਹਾਸ ਦੇ ਵਿੱਚ ਕੀ ਆ ਪੰਜਾਬੀ ਪੰਜਾਬ ਦੇ ਵਿੱਚ ਜਿਹੜਾ ਹੜੱਪਾ ਸੱਭਿਅਤਾ

ਸਿੱਖ ਸਾਮਰਾਜ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੈਗਾ ਸਿੱਖ ਸਾਮਰਾਜ ਦੌਰਾਨ ਵੀ ਪੰਜਾਬੀ ਕਲਾ ਅਤੇ ਸ਼ਿਲਪਕਾਰੀ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਸੀਗਾ ਜਿਵੇਂ ਇਸ ਇਸ ਵੇਲੇ ਕੀ ਅੰਬਰਸਰ ਦੇ ਵਿੱਚ ਸੁਨਹਿਰੀ ਮੰਦਰ ਬਣਿਆ ਹੋਇਆ ਹੈਗਾ ਅਤੇ ਹੋਰ ਵੀ ਗੁਰਦੁਆਰੇ ਪੰਜਾਬੀ ਕਲਾਕਾਰੀ ਦੇ ਨਮੂਨੇ ਹਨ ਅਤੇ ਜਿਹੜੇ ਕਿ ਇਸ ਆਮ ਤੌਰ 'ਤੇ ਫਿਲਮਾਂ ਦੇ ਵਿੱਚ ਵੀ ਅਤੇ ਹੋਰ ਥਾਵਾਂ 'ਤੇ ਵੀ ਵਰਤੇ ਜਾਂਦੇ ਹਨ ਬਹੁਤ ਬਹੁਤ ਧੰਨਵਾਦ ਜੀ